ਘੋੜ ਸਵਾਰੀ ਕਰਨ ਦੇ ਲਈ ਮੇਰੀ ਪਸੰਦੀਦਾ ਟਰੇਲ ਕੱਚਾ ਰਸਤਾ ਹੈ ਚਾਹੇ ਉਹ ਰਸਤਾ ਮੈਦਾਨੀ ਇਲਾਕੇ ਦਾ ਹੋਵੇ ਚਾਹੇ ਪਰਬਤੀ ਇਲਾਕਾ ਹੋਵੇ ਚਾਹੇ ਉਹ ਜੰਗਲੀ ਇਲਾਕਾ ਹੋਵੇ ਕਿਉਂਕਿ ਕੱਚੇ ਰਸਤੇ ਪਰ ਚੱਲਣ ਦੇ ਨਾਲ ਘੋੜ ਸਵਾਰੀ ਕਰਨ ਦੇ ਨਾਲ ਘੋੜਾ ਛੇਤੀ ਥੱਕਦਾ ਨਹੀਂ ਹੈ ਪੱਕੇ ਰਾਹ ਦੇ ਉੱਤੇ ਘੋੜਾ ਬੜੀ ਛੇਤੀ ਥੱਕ ਜਾਂਦਾ ਹੈ ਜਿਹਦੇ ਕਰਕੇ ਲੰਬੀ ਘੋੜ ਸਵਾਰੀ ਕਰਨ ਦੇ ਲਈ ਫਿਰ ਘੋੜੇ ਨੂੰ ਰਾਹਾਂ ਵਿੱਚ ਸਾਹ ਦਵਾਉਣਾ ਪੈਂਦਾ ਹੈ ਰੋਕਣਾ ਪੈਂਦਾ ਹੈ ਜਿਹਦੇ ਨਾਲ ਕਰਕੇ ਸਮਾਂ ਵੀ ਜ਼ਿਆਦਾ ਖ਼ਰਾਬ ਹੁੰਦਾ ਹੈ ਕੱਚੇ ਰਾਹਾਂ ਦੇ ਉੱਤੇ ਘੋੜਾ ਜ਼ਿਆਦਾ ਥੱਕਦਾ ਨਹੀਂ ਹੈ ਅਤੇ ਉਹਨੂੰ ਪਿਆਸ ਵੀ ਛੇਤੀ ਨਹੀਂ ਲੱਗਦੀ ਅਤੇ ਉਹ ਇੱਕੋ ਵਾਰ ਸਵਾਰੀ ਕਰਨ ਦੇ ਨਾਲ ਅਸੀਂ ਲੰਬਾ ਸਮਾਂ ਤੈਅ ਕਰ ਸਕਦੇ ਹਾਂ